ਹੈਲੋ ਹਾਂਜੀ ਢਿੱਲੋਂ ਕਾਰ ਬਜ਼ਾਰ ਤੋਂ ਬੋਲ ਰਹੇ ਹੋ ਸਰ ਇੱਕ ਦਿੱਲੀ ਨੰਬਰ ਦੀ ਕਾਰ ਦੇਖਣੀ ਸੀ ਅੱਛਾ ਅੱਛਾ ਅੱਛਾ ਡਿਜ਼ਾਇਰ 'ਚ ਹੈਗੀ ਦੋ ਤੋਂ ਤਿੰਨ ਲੱਖ 'ਚ ਓਕੇ ਹਮ ਅੱਛਾ ਔਰ ਲੱਗੀ ਲੁੱਗੀ ਤਾਂ ਨਹੀਂ ਕਿਸੇ ਪਾਸੋਂ ਹਾਂਜ ਹਾਂਜੀ ਹਾਂਜੀ ਹਮ ਹਾਂ ਹਾਂਜੀ ਚੱਲੋ ਮੈਂ ਆਉਂਦੀ ਹਾਂ ਜੀ ਦੇਖ ਕੇ ਜਾਂਦੀ ਹਾਂ ਡਿਜ਼ਾਇਰ ਵੇਖ ਕੇ ਜਾਂਦੀ ਹੈ ਚੱਲੋ ਠੀਕ ਹੈ ਜੀ ਠੀਕ ਹੈ ਜੀ ਮੈਂ ਆਉਂਦੀ ਹੈ ਜੀ ਠੀਕ ਠੀਕ ਹੈ